ਅੱਜ ਕੱਲ੍ਹ ਦੇ ਸਮੇਂ ਵਿੱਚ ਔਰਤਾਂ ਹਰ ਕਾਰਜ ਵਿੱਚ ਯੋਗਦਾਨ ਪਾ ਰਹੀਆਂ ਹਨ ਜਿਸ ਤਰ੍ਹਾਂ ਕਿ ਪਹਿਲਾਂ ਔਰਤਾਂ ਘਰੇਲੂ ਕਾਰਜ ਵਿੱਚ ਹੀ ਰਹਿੰਦੀਆਂ ਸੀ ਅਤੇ ਬਾਹਰ ਜਾਣ ਲੱਗਿਆ ਸੁਰੱਖਿਅਤ ਮਹਿਸੂਸ ਕਰਦੀਆਂ ਸੀ ਅਤੇ ਹੁਣ ਅੱਜ ਕੱਲ੍ਹ ਦੇ ਵਿੱਚ ਹਰ ਸਰਵਿਸ ਵਿੱਚ ਹਰ ਕਾਰਜ ਵਿੱਚ ਔਰਤਾਂ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ ਜਿਨ੍ਹਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਡਰ ਨਹੀਂ ਅਤੇ ਆਪਣੀ ਹਰ ਭੂਮਿਕਾ ਜਦੋਂ ਨਿਭਾਉਂਦੀਆਂ ਆ ਰਹੀਆਂ ਹਨ ਹਰ ਕਾਰਜ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਹਨ ਅਤੇ ਪੂਰਾ ਨਾਂ ਰੋਸ਼ਨ ਕਰ ਰਹੀਆਂ ਹਨ ਖੇਡਾਂ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਔਰ ਸਰਵਿਸ ਦੇ ਵਿੱਚ ਜਿਹੜੀਆਂ ਜਿਹੜੀਆਂ ਜੋ ਵੀ ਉਹਨਾਂ ਨੂੰ ਮਿਲਦੀ ਇਹ ਚੀਜ਼ ਜਿਹੜੀ ਵੀ ਜਾਣੀ ਕਿ ਉਹਦਾ ਹਰ ਸਰਵਿਸ ਦੇ ਵਿੱਚ ਯੋਗਦਾਨ ਪਾ ਰਹੀਆਂ ਹਨ ਉਹਨਾਂ ਦੀ ਇਸ ਵਕਤ ਵੋਟਾਂ ਦੀ ਪੋਜੀਸ਼ਨ ਮਰਦਾਂ ਦੇ ਮੁਕਾਬਲੇ ਬਰਾਬਰ 'ਤੇ ਜਾ ਰਹੀ ਹੈ